ਬਹੁਤ ਸਾਰੇ ਪਿੰਡਾਂ ਵਿੱਚ ਨਾਚ ਮਹੱਤਵਪੂਰਨ ਸੱਭਿਆਚਾਰਕ ਅਤੇ ਸਮਾਜਿਕ ਮਹੱਤਤਾ ਰੱਖਦਾ ਹੈ ਸੰਪਰਦਾਇਕ ਜੀਵਨ ਅਤੇ ਪਰੰਪਰਾ ਦੇ ਇੱਕ ਮੁੱਖ ਤੱਤ ਵਜੋਂ ਸੇਵਾ ਕਰਦਾ ਹੈ ਇਹ ਅਕਸਰ ਤਿਉਹਾਰਾਂ ਜਸ਼ਨਾਂ ਅਤੇ ਸਮਾਰੋਹਾਂ ਦੀ ਕੇਂਦਰੀ ਵਿਸ਼ੇਸ਼ਤਾ ਹੁੰਦੀ ਹੈ ਜੋ ਸਥਾਨਕ ਵਿਰਾਸਤ ਅਤੇ ਰੀਤੀ ਰਿਵਾਜ਼ਾਂ ਨੂੰ ਦਰਸਾਉਂਦੀ ਹੈ ਲੋਕ ਜੋਸ਼ੀਲੇ ਪ੍ਰਦਰਸ਼ਨਾਂ ਅਤੇ ਭਾਗੀਦਾਰੀ ਸਮਾਗਮਾਂ ਰਾਹੀਂ ਡਾਂਸ ਦਾ ਆਨੰਦ ਲੈਂਦੇ ਹਨ ਜਿੱਥੇ ਰਵਾਇਤੀ ਲੋਕ ਨਾਚ ਜਵਾਨ ਅਤੇ ਬੁੱਢੇ ਦੋਵੇਂ ਦੁਆਰਾ ਪੇਸ਼ ਕੀਤੇ ਜਾਂਦੇ ਹਨ ਇਹ ਇਕੱਠ ਏਕਤਾ ਅਤੇ ਭਾਈਚਾਰਾ ਦੀ ਭਾਵਨਾ ਪੈਦਾ ਕਰਦੇ ਹਨ ਕਿਉਂਕਿ ਇਹ ਸਾਂਝੀਆਂ ਕਦਰਾਂ ਕੀਮਤਾਂ ਅਤੇ ਸੱਭਿਆਚਾਰਕ ਪਛਾਣ ਦਾ ਜਸ਼ਨ ਮਨਾਉਣ ਲਈ ਲੋਕਾਂ ਨੂੰ ਇਕੱਠੇ ਕਰਦੇ ਹਨ ਪਿੰਡਾਂ ਵਿੱਚ ਡਾਂਸ ਵਿੱਚ ਅਕਸਰ ਜੀਵੰਤ ਸੰਗੀਤ ਰੰਗੀਨ ਪਹਿਰਾਵੇ ਅਤੇ ਊਰਜਾਵਾਨ ਹਰਕਤਾਂ ਸ਼ਾਮਿਲ ਹੁੰਦੀਆਂ ਹਨ ਜੋ ਖੁਸੀ ਅਤੇ ਸਮੂਹਿਕ ਜਸ਼ਨ ਦਾ ਮਾਹੌਲ ਬਣਾਉਂਦੀਆਂ ਹਨ